ਅਸੀਂ ਆਪਣੇ ਬੱਚੇ ਦਾ ਨਾਂ ਬਹੁਤ ਹੀ ਪਿਆਰ ਨਾਲ ਰੱਖਿਆ ਸੀਗਾ ਜੋ ਕਿ ਅਸੀਂ ਸਕੂਲ ਵਿੱਚ ਉਸਨੂੰ ਦਾਖਲ ਕਰਵਾਇਆ ਦਾਖਲ ਕਰਵਾਉਣ ਉਪਰੰਤ ਜੋ ਕਿ ਸਾਨੂੰ ਹੌਲੀ ਹੌਲੀ ਪਤਾ ਚੱਲਿਆ ਸਕੂਲ ਵੱਲੋਂ ਕਿ ਉਸ ਦੇ ਨਾਂ ਵਿੱਚ ਸੰਬੰਧਿਤ ਸਰਟੀਫਿਕੇਟ ਵਿੱਚ ਗਲਤੀ ਹੈ ਜੋ ਕਿ ਅਸੀਂ ਉਸਨੂੰ ਸੁਧਾਰਨ ਲਈ ਸੁਵਿਧਾ ਕੇਂਦਰ ਵਿੱਚ ਗਏ ਉਹਨਾਂ ਨੇ ਸਾਨੂੰ ਇੱਕ ਫਾਰਮ ਦਿੱਤਾ ਫਾਰਮ ਉੱਤੇ ਫਾਰਮ ਉੱਤੇ ਅਸੀਂ ਹੱਥ ਰਾਹੀਂ ਜੋ ਕਿ ਸੰਬੰਧਿਤ ਜੋ ਵੀ ਜਾਣਕਾਰੀ ਮੰਗੀ ਸੀ ਅਸੀਂ ਉਹ ਜਾਣਕਾਰੀ ਉਸ ਫਾਰਮ ਵਿੱਚ ਲਿਖੀ ਉਸ ਤੋਂ ਬਾਅਦ ਅਸੀਂ ਸਰਪੰਚ ਵੱਲੋਂ ਮੋਹਰ ਲਗਵਾ ਕੇ ਸੰਬੰਧਿਤ ਸੁਵਿਧਾ ਕੇਂਦਰ ਵਿੱਚ ਫਿਰ ਜਮ੍ਹਾਂ ਕਰਵਾਉਣ ਗਏ ਉਹਨਾਂ ਨੇ ਸਾਨੂੰ ਇੱਕ ਰਸੀਦ ਦਿੱਤੀ ਰਸੀਦ ਦੇ ਉੱਪਰ ਕੁਛ ਨੰਬਰ ਲਿਖੇ ਹੋਏ ਸੀ ਜੋ ਕਿ ਔਨਲਾਇਨ ਚੈੱਕ ਕਰਨੇ ਸੀਗੇ ਕਿ ਜੋ ਕਿ ਅਸੀਂ ਜੋ ਕਿ ਬਿਨੈ ਪੱਤਰ ਅਸੀਂ ਸੁਵਿਧਾ ਕੇਂਦਰ ਵਿੱਚ ਜਮ੍ਹਾਂ ਕਰਵਾਇਆ ਹੈ ਉਸ ਦੀ ਤਰੁਟੀ ਦੂਰ ਹੋਈ ਹੈ ਕਿ ਨਹੀਂ ਹੋਈ ਉਸ ਦੀ ਤਰੁਟੀ ਦੂਰ ਕਰਨ ਵਾਸਤੇ ਜੋ ਕਿ ਅਈਮੇਲ ਐਡਰੈਸ ਸੀ ਸੁਵਿਧਾ ਕੇਂਦਰ ਤੋਂ ਪ੍ਰਾਪਤ ਕੀਤਾ ਅਤੇ ਉਸ ਈਮੇਲ ਆਈ ਡੀ ਉੱਤੇ ਅਸੀਂ ਬਾਰ ਬਾਰ ਉਸਦੇ ਚੈੱਕ ਕਰਦੇ ਰਹੇ ਕਿ ਸਾਡਾ ਨਾਮ ਜੋ ਗਲਤ ਸੀਗਾ ਰਾਮ ਕੁਮਾਰ ਸੀਗਾ ਜੋ ਕਿ ਆਪ ਜੀ ਵੱਲੋਂ ਰਾਮ ਸਿੰਘ ਲਿਖਿਆ ਗਿਆ ਹੋਇਆ ਸੀ ਉਹ ਸਹੀ ਹੋਇਆ ਕਿ ਨਹੀਂ ਹੋਇਆ ਅਸੀਂ ਉਸ ਨੂੰ ਵਾਰੀ ਵਾਰੀ ਚੈੱਕ ਕਰਦੇ ਰਹੇ ਹਾਂ ਅਤੇ ਸਾਨੂੰ ਫਿਰ ਜਦੋਂ ਪੰਦਰ੍ਹਵੇਂ ਵੀਹਵੇਂ ਪੰਦਰ੍ਹਾਂ ਦਿਨਾਂ ਬਾਅਦ ਅਸੀਂ ਫਿਰ ਚੈੱਕ ਕੀਤਾ ਤਾਂ ਉਸ ਵਿੱਚ ਸਾਨੂੰ ਦੇਖ ਕੇ ਖੁਸ਼ੀ ਮਹਿਸੂਸ ਹੋਈ ਕਿ ਜੋ ਕਿ ਅਸੀਂ ਨਾਂ ਸਹੀ ਕਰਵਾਉਣਾ ਚਾਹੁੰਦੇ ਸੀ ਬੱਚੇ ਦਾ ਜੋ ਕਿ ਨਾਮ ਉਸਦਾ ਸਹੀ ਹੋ ਗਿਆ ਇਸ ਦੇ ਇਸ ਕਰਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ